ਮੈਂ ਇੱਕ ਅਜਿਹੇ ਵਿਅਕਤੀ ਨੂੰ ਜਾਣਦੀ ਹਾਂ ਜੋ ਆਪਣੇ ਜ਼ਿੰਦਗੀ ਦੇ ਰੁਝਾਵਾਂ ਤੋਂ ਵਿਹਲਾ ਹੋ ਕੇ ਆਪਣੀ ਮਰਜ਼ੀ ਦੇ ਨਾਲ ਆਪਣੇ ਮਨ ਦੀ ਖੁਸ਼ੀ ਦੇ ਲਈ ਚਿੱਤਰਕਾਰੀ ਕਰਨਾ ਚਾਹੁੰਦਾ ਹੈ ਅਤੇ ਉਹ ਬਹੁਤ ਪਿਆਰ ਦੇ ਨਾਲ ਬਹੁਤ ਦਿਲ ਦੇ ਨਾਲ ਚਿੱਤਰਕਾਰੀ ਕਰ ਰਿਹਾ ਹੈ ਅਤੇ ਮੇਰੀ ਉਸਨੂੰ ਇੱਕ ਸਲਾਹ ਹੈ ਕਿ ਉਹ ਜੋ ਵੀ ਕਰਨਾ ਚਾਹੁੰਦਾ ਹੈ ਆਪਣੀ ਖੁਸ਼ੀ ਦੇ ਲਈ ਕਰੇ ਅਤੇ ਉਹ ਕਿਸੇ ਚੰਗੇ ਚਿੱਤਰਕਾਰ ਨਾਲ ਕੋਲੋਂ ਇਸ ਦੀ ਟ੍ਰੇਨਿੰਗ ਲੈ ਕੇ ਆਪਣੇ ਹੁਨਰ ਨੂੰ ਹੋਰ ਚੰਗੀ ਤਰ੍ਹਾਂ ਨਿਖਾਰ ਕੇ ਅੱਗੇ ਵ